ਬਾਰਾਂ ਅਗਸਤ ਪੰਦਰਾਂ ਸੌ ਸੱਠ ਚਾਰ ਜਨਵਰੀ ਉੱਨੀ ਸੌ ਨੱਬੇ ਚੌਦਾਂ ਸਤੰਬਰ ਦੋ ਹਜ਼ਾਰ ਅੱਠ ਇੱਕੀ ਜੁਲਾਈ ਉੱਨੀ ਸੌ ਨੜਿਨਵੇਂ ਪੰਦਰਾਂ ਫਰਵਰੀ ਅਠਾਰਾਂ ਸੌ ਨੱਬੇ